ਭਾਰਤ ਨੂੰ ਅਸੀਂ ਮੁੱਖ ਤੌਰ 'ਤੇ ਦੋ ਹਿੱਸਿਆਂ ਵਿੱਚ ਵੰਡਦੇ ਹਾਂ ਉੱਤਰੀ ਭਾਰਤ ਅਤੇ ਦੱਖਣੀ ਭਾਰਤ ਉੱਤਰੀ ਭਾਰਤ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਪੰਜਾਬ ਹਰਿਆਣਾ ਹਿਮਾਚਲ ਆਦਿ ਸ ਸਟੇਟ ਆਉਂਦੇ ਹਨ ਅਤੇ ਜੇਕਰ ਅਸੀਂ ਦੱਖਣੀ ਭਾਰਤ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਕੇਰਲਾ ਚੇਨਈ ਤਾਮਿਲਨਾਡੂ ਆਦਿ ਸਟੇਟ ਆਉਂਦੇ ਹਨ ਉੱਤਰੀ ਭਾਰਤ ਵਿੱਚ ਪੰਜਾਬੀ ਹਰਿਆਣਵੀ ਡੋਂਗਰੀ ਆਦਿ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ਅਤੇ ਦੂਜੀ ਤਰਫ ਦੱਖਣੀ ਭਾਰਤ ਦੇ ਵਿੱਚ ਤਾਮਿਲਨਾਡੂ ਮਲਿਆਲਮ ਤੇਲਗੂ ਆਦਿ ਭਾਸ਼ਾ ਬੋਲੀਆਂ ਜਾਂਦੀਆਂ ਹਨ ਉੱਤਰੀ ਭਾਰਤ ਵਿੱਚ ਲੋਕ ਜ਼ਿਆਦਾ ਫੈਂਸ਼ਨਏਬਲ ਹਨ ਲੇਕਿਨ ਦੂਜੀ ਤਰਫ ਦੱਖਣੀ ਭਾਰਤ ਦੇ ਵਿੱਚ ਲੋਕ ਬਹੁਤ ਹੀ ਸਾਦੇ ਅਤੇ ਸੋਬਰ ਰਹਿਣਾ ਪਸੰਦ ਕਰਦੇ ਹਨ ਸਾਡੇ ਪੰਜਾਬ ਦੇ ਵਿੱਚ ਉੱਤਰੀ ਭਾਰਤ ਦੇ ਵਿੱਚ ਮੱਕੀ ਦੀ ਰੋਟੀ ਸਰਸੋਂ ਦਾ ਸਾਗ ਅਤੇ ਕੁਛ ਹੋਰ ਮਸਾਲੇਦਾਰ ਸਬਜ਼ੀਆਂ ਫੇਮਸ ਹਨ ਲੇਕਿਨ ਦੱਖਣੀ ਭਾਰਤ ਦੇ ਵਿੱਚ ਇਡਲੀ ਸਾਂਬਰ ਅਤੇ ਬਹੁਤ ਹੀ ਸਾਦਾ ਖਾਣਾ ਪਸੰਦ ਕੀਤਾ ਜਾਂਦਾ ਹੈ